ਮੈਂ ਆਪਣੇ ਚੱਲ ਰਹੇ ਟੀਚਿਆਂ ਇਸ ਗੱਲ ਦੇ ਨਾਲ ਨਿਰਧਾਰਿਤ ਕਰਦਾ ਹਾਂ ਕਿ ਮੈਂ ਜਿਸ ਵੀ ਮੈਰਾਥੋਨ ਦੇ ਵਿੱਚ ਹਿੱਸਾ ਲੈਣਾ ਹੋਵੇ ਮੈਂ ਉਸ ਵਿੱਚ ਕੁੱਲ ਕਿੰਨੇ ਸੌ ਮੀਟਰ ਦੀ ਦੂਰੀ ਨੂੰ ਤੈਅ ਕਰਨਾ ਹੈ ਜਿਵੇਂ ਕਿ ਮੈਂ ਪੰਦਰਾਂ ਸੌ ਮੀਟਰ ਦੀ ਦੂਰੀ ਨੂੰ ਪੰਜ ਮਿੰਟ ਵਿੱਚ ਤੈਅ ਕਰਨਾ ਹੋਵੇ ਤਾਂ ਮੈਂ ਉਸਨੂੰ ਮੰਨ ਕੇ ਚਲਦਾ ਹਾਂ ਕਿ ਪੰਦਰਾਂ ਸੌ ਮੀਟਰ ਦੀ ਦੂਰੀ ਨੂੰ ਮੈਂ ਚਾਰ ਮਿੰਟ ਵਿੱਚ ਹੀ ਤੈਅ ਕਰਨਾ ਹੈ ਅਤੇ ਉਸਦੇ ਅਕੋਰਡਿੰਗ ਮੈਂ ਆਪਣੀ ਤਿਆਰੀ ਵੀ ਕਰਦਾ ਹਾਂ ਰੋਜ਼ ਪਰੈਕਟਿਸ ਕਰਦਾ ਹਾਂ ਰੋਜ਼ ਦੌੜ ਲਾਉਣ ਜਾਂਦਾ ਹਾਂ ਹੋਰ ਉਸ ਦੇ ਨਾਲ ਨਾਲ ਕਈ ਤਰ੍ਹਾਂ ਦੇ ਇਹੋ ਜਿਹੇ ਭੋਜਨ ਦਾ ਵੀ ਸੇਵਨ ਕਰਦਾ ਹਾਂ ਜੋ ਕਿ ਮੇਰੇ ਸਾਹ ਪ੍ਰਣਾਲੀ ਨੂੰ ਮਜ਼ਬੂਤ ਰੱਖਦੇ ਹਨ ਤਾਂ ਜੋ ਮੈਨੂੰ ਦੌੜ ਦੇ ਦੌਰਾਨ ਸਾਹ ਵਗੈਰਾ ਨਾ ਚੜ੍ਹੇ ਤਾਂ ਜੋ ਮੈਂ ਲੰਬੀ ਦੂਰੀ ਤੈਅ ਕਰ ਸਕਾਂ ਅਗਰ ਦੂਜਿਆਂ ਦੀ ਸਲਾਹ ਦੀ ਗੱਲ ਕਰ ਲਈਏ ਤਾਂ ਉਸ ਨਾ ਨੂੰ ਪਹਿਲਾਂ ਤਾਂ ਅਭਿਆਸ ਕਰਨਾ ਚਾਹੀਦਾ ਹੈ ਅਭਿਆਸ ਕਰਕੇ ਹੀ ਉਹਨਾਂ ਦਾ ਸਾਹ ਦਾ ਸੈੱਟ ਹੋਵੇਗਾ ਨਹੀਂ ਤਾਂ ਉਹਨਾਂ ਨੂੰ ਸਾਹ ਚੜ੍ਹਨ ਲੱਗ ਪਵੇਗਾ ਅਤੇ ਉਹਨਾਂ ਨੂੰ ਹੋਰ ਤਰ੍ਹਾਂ ਦੇ ਕਈ ਭੋਜਨ ਦਾ ਸੇਵਨ ਕਰਨਾ ਪਵੇਗਾ ਜਿਹੜੇ ਹੈਲਦੀ ਹੋਣ ਅਤੇ ਉਹਨਾਂ ਨੂੰ ਸਾਹ ਦੀ ਪ੍ਰਣਾਲੀ ਨੂੰ ਪੱਕਾ ਕਰਨ ਵਿੱਚ ਮਦਦ ਕਰਨਾ ਜੇਕਰ ਮੇਰੇ ਪਸੰਦੀਦਾ ਖਿਡਾਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਮੇਰਾ ਪਸੰਦੀਦਾ ਦੌੜਾਕ ਮਿਲਖਾ ਸਿੰਘ ਹੈ ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ